ਹਾਂ ਬਾਈ ਕਿਵੇਂ ਆ ਵਧੀਆ ਵਧੀਆ ਮੈ ਯਾਰ ਹੋਸਟਲ 'ਚ ਸੀਗਾ ਹਮ ਹਾਂ ਹਾਂ ਹਾਂ ਯਾਰ ਉਹ ਤਾਂ ਹੈ ਮੈਂ ਵੀ ਅੱਕਿਆ ਪਿਆ ਹਮ ਹਮ ਹਮ ਠੀਕ ਹੈ ਯਾਰ ਹਾਂ ਬਾਈ ਕੋਈ ਨਾ ਪੁੱਛ ਲੈਂਦੇ ਹਾਂ ਹਮ ਹਮ ਆਹੋ ਨਾਲ ਬਾਹਰ ਰੋਟੀ ਵਧੀਆ ਮਿਲ ਜਾਂਦੀ ਹੈ ਹਮ ਹਮ ਹਮ ਆਹੋ ਆਹੋ ਹਾਂ ਉਹ ਤਾਂ ਹੈ ਬਈ ਪੈਸੇ ਤਾਂ ਬਚਾਉਣੇ ਆ ਹਾਂ ਉਰੇ ਹੋਸਟਲ ਦੇ ਵਿੱਚ ਵਾਈਫਾਈ ਵੀ ਸੈਟ ਨਹੀਂ ਚੱਲਦਾ ਉਰੇ ਅੱਛਾ ਹਮ ਹਮ ਅੱਛਾ ਹਮ ਸਹੀ ਗੱਲ ਆ ਕਿਹੜੇ ਬਾਈ ਕਿਹੜੇ ਕਿਹੜੇ ਫਰਨੀਚਰ ਵਾਲੇ ਉਰੇ ਉਹ ਆ ਪੀਜੀ ਵਾਲੇ ਵੈਸੇ ਤਾਂ ਜ਼ਿਆਦਾਤਰ ਹਰਮਨ ਵਾਲੇ ਕੋਲ ਹੀ ਜਾਂਦੇ ਆ ਕਹਿੰਦੇ ਸਸਤਾ ਵੀ ਹੈ ਨਾਲੇ ਜਵਾਕਾਂ ਲਈ ਵਧੀਆ ਖਰਚਾ ਬਾਈ ਸੁਣਨ 'ਚ ਆਇਆ ਦੋ ਤਿੰਨ ਹਜ਼ਾਰ ਹੋਵੇਗਾ ਹਮ ਗੋਲ ਚੌਂਕ ਦੇ ਕੋਲ ਆ ਉਹ ਹਾਂ ਹਾਂ ਆਪਾਂ ਨੂੰ ਕੋਲਜ ਤੋਂ ਪਰਮੀਸ਼ਨ ਵੀ ਲੈਣੀ ਪੈਣੀ ਆ ਹੋਸਟਲ ਛੱਡ ਰਹੇ ਹਾਂ ਹਾਂ ਹਾਂ ਕੋਈ ਨਾ ਬਾਈ ਹਫਤੇ ਤੱਕ ਕਹਿੰਦੇ ਸੀਗੇ ਰੂਮ ਖਾਲੀ ਹੋ ਜੂਗਾ ਮਿਲ ਜੂਗਾ ਕੋਈ ਨਾ ਕੋਈ ਨਾ ਓਕੇ